ਮੈਂ ਆਪਣੀਆਂ ਖਿੱਚੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਆਪਣੀ ਲਾਈਬ੍ਰੇਰੀ ਦੇ ਵਿੱਚ ਲਗਾਈ ਸੀ ਜਿੱਥੇ ਮੈਂ ਆਪਣੇ ਫੋਨ ਤੋਂ ਖਿੱਚੀਆਂ ਅਤੇ ਕੈਮਰੇ ਤੋਂ ਖਿੱਚੀਆਂ ਕੁਝ ਕੁਦਰਤੀ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਇਹ ਪ੍ਰਦਰਸ਼ਨੀ ਮੇਰੇ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਲੱਗੀ ਸੀ ਅਤੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਬਹੁਤ ਹੀ ਸਰਾਹਣਾ ਮਿਲੀ ਮੇਰੇ ਸਕੂਲ ਦੀਆਂ ਟੀਚਰਾਂ ਨੇ ਉੱਥੋਂ ਦੇ ਵਿਦਿਆਰਥੀਆਂ ਨੇ ਅਤੇ ਉੱਥੇ ਪੁੱਜੇ ਉਹਨਾਂ ਦੇ ਮਾਤਾ ਪਿਤਾ ਨੇ ਸਭ ਨੇ ਉਹਨਾਂ ਕੁਦਰਤੀ ਨਜ਼ਾਰਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਿਸ ਨਾਲ ਮੇਰਾ ਮਨੋਬਲ ਦੇ ਵਿੱਚ ਬਹੁਤ ਵਾਧਾ ਹੋਇਆ ਅਤੇ ਮੈਂ ਆਪਣੀ ਇਸ ਤਸਵੀਰਾਂ ਖਿੱਚਣ ਦੀ ਹੈਬਿਟ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹਿਆ